ਸਤਿ ਸ਼੍ਰੀ ਅਕਾਲ ਜੀ ਤੁਸੀਂ ਭੈਣਾਂ ਦੇ ਢਾਬੇ ਤੋਂ ਬੋਲਦੇ ਹੋ ਮੈਂ ਤੁਹਾਨੂੰ ਵੀਹ ਮਿੰਟ ਪਹਿਲਾਂ ਖਾਣੇ ਦਾ ਆਡਰ ਦਿੱਤਾ ਸੀ ਮੇਰੇ ਆਡਰ ਵਿੱਚ ਚਾਰ ਰੋਟੀਆਂ ਦਾਲ ਮੱਖਣੀ ਅਤੇ ਸਲਾਦ ਸੀ ਪਹਿਲਾਂ ਤੁਹਾਨੂੰ ਮੈਂ ਆਪਣੇ ਘਰ ਦਾ ਪਤਾ ਦਿੱਤਾ ਸੀ ਪਰ ਕਿਸੀ ਕਾਰਨ ਕਰਕੇ ਮੈਨੂੰ ਹੋਰ ਜਗ੍ਹਾ ਜਾਣਾ ਪੈ ਗਿਆ ਮੈਂ ਤੁਹਾਨੂੰ ਉਸ ਜਗ੍ਹਾ ਦਾ ਪਤਾ ਲਿਖਵਾ ਦਿੰਦੀ ਹਾਂ ਕਿਰਪਾ ਕਰਕੇ ਤੁਸੀਂ ਇਸ ਪਤੇ 'ਤੇ ਮੇਰਾ ਆਡਰ ਭੇਜ ਦਿਓ ਕੋਠੀ ਨੰਬਰ ਚਾਰ ਸੌ ਦਸ ਫੇਸ ਪੰਜ ਨੇੜੇ ਚਾਵਲਾ ਹਸਪਤਾਲ ਇਹ ਐਡਰੈੱਸ ਤੁਸੀਂ ਆਪਣੇ ਡਿਲੀਵਰੀ ਮੈਨ ਨੂੰ ਦੇ ਦੇਣਾ ਤਾਂ ਜੋ ਕਿ ਉਹ ਸਮੇਂ 'ਤੇ ਮੇਰਾ ਆਡਰ ਪਹੁੰਚਾ ਦੇਵੇ